ਪੰਜਾਬ ਦੀ ਕਲਾ ਗੱਤਕਾ ਇੱਕ ਖੇਡ ਖੇਡ ਦੇ ਰੂਪ ਵਿੱਚ ਅੱਜ ਨੈਸ਼ਨਲ ਤੱਕ ਪਹੁੰਚ ਗਈ ਹੈ ਅਤੇ ਪੰਜਾਬ ਆਪੋ ਆਪਦੇ ਵਿੱਚ ਹੀ ਅਨਾਜ ਅਨਾਜ ਅਤੇ ਕਿਸਾਨਾਂ ਸਾਡੇ ਭਾਰਤ ਦੇਸ਼ ਨੂੰ ਬਹੁਤ ਕੁਸ਼ ਪ੍ਰਦਾਨ ਕਰਦੇ ਹਨ ਇਹ ਸਾਡੇ ਭਾਰਤ ਦੇਸ਼ ਨੂੰ ਅਮੀਰ ਬਣਾਉਦੇ ਹਨ ਤੇ ਬੱਚਿਆਂ ਪੰਜਾਬ ਦੇ ਬਾਹਰ ਜਾ ਕੇ ਨਾਂ ਰੋਸ਼ਨ ਕਰਦੇ ਹਨ ਖੇਡਾਂ ਦੇ ਵਿੱਚ ਨਾਂ ਰੋਸ਼ਨ ਕਰਦੇ ਹਨ ਤੇ ਇਹ ਵੀ ਬਹੁਤ ਕੁਛ ਪੰਜਾਬ ਦਾ ਯੋਗਦਾਨ ਨੇ ਭਾਰਤ ਦੇਸ਼ ਦੇ ਵਿੱਚ ਹੱਦ ਤੋਂ ਵੱਧ ਹੈ